ਹੈਲੋ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਚੱਲਦਾ ਪਿਆ ਮੈਂ ਤਾਂ ਸੁਣਿਆ ਸੀ ਤੁਸੀਂ ਥੋੜ੍ਹੀ ਕੁ ਜਮੀਨ ਲਿੱਤੀ ਆ ਪਿਛਲੀ ਵਾਰ ਮੈਂ ਮੈਂ ਤਾਂ ਬਸ ਕੁਝ ਅੱਧਾ ਕਿੱਲਾ ਜਮੀਨ ਲਿੱਤੀ ਸੀ ਅਤੇ ਉਹਦਾ ਲੈਣ ਦਾ ਕੋਈ ਫਾਇਦਾ ਵੀ ਨਹੀਂ ਹੋਇਆ ਨਾ ਇਸ ਉਹਦੇ 'ਤੇ ਜਿਹੜੀ ਮੂੰਗੀ ਬੀਜੀ ਸੀ ਉਹਦਾ ਕੁਛ ਬਣਿਆ ਨਾ ਜਿਹੜੀ ਜਮੀਨ ਲਿੱਤੀ ਉਹ 'ਤੇ ਪੈਸਾ ਲਾਇਆ ਉਹ ਸਾਰਾ ਫੂਕਿਆ ਗਿਆ ਇੱਦਾਂ ਹੀ ਗਲੋਬਲ ਵਾਰਮਿੰਗ ਹੋਈ ਬੜੀ ਪਈ ਹੈ ਕਿ ਗਰਮੀ ਇੰਨੀ ਵੱਧ ਗਈ ਹੈ ਕਿ ਮਤਲਬ ਕੁਛ ਹੋ ਹੀ ਨਹੀਂ ਸਕਦਾ ਸਰਕਾਰ ਸਰਕਾਰ ਬਸ ਨਵੀਆਂ ਗੱਡੀਆਂ ਬਣਾਇਆ ਕਰਦੀ ਹੈ ਅਤੇ ਪਿਛਲਾ ਦੇਖਿਆ ਨਹੀਂ ਕਰਦੀ ਕਿ ਕੀ ਹਾਲ ਹੋਇਆ ਕਰਦਾ ਉਹ ਨੂੰ ਬਸ ਐਡਵਾਂਸ ਹੋਣ ਦੀ ਪਈ ਵੀ ਆ ਹਾਂ ਬਿਲਕੁਲ ਸਹੀ ਕਿਹਾ ਹਾਂ ਕੁਛ ਨਵੀਂ ਟੈਕਨੋਲੋਜੀ ਲਿਆਉਣੀ ਚਾਹੀਦੀ ਆ ਜਿਹਦੇ ਨਾਲ ਕਿਸਾਨ ਵੀ ਆਪਣੀ ਫ਼ਸਲ ਖੇਤੀ ਚੰਗੀ ਤਰ੍ਹਾਂ ਕਰ ਸਕੇ ਪਰ ਪਰ ਇਹਨਾਂ ਦਾ ਤਾਂ ਕੋਈ ਅਸਰ ਹੀ ਹੈ ਨਹੀਂ ਆ ਉਲਟਾ ਰੋਜ਼ ਕਿਸਾਨ ਭੁੱਖ ਨਾਲ ਮਰ ਰਿਹਾ ਆਹ ਸਾਡੇ ਸਾਡੇ ਵੀ ਹੋਇਆ ਸੀ ਸਾਡੇ ਹੁਣ ਪਿੱਛੇ ਲਾਗੇ ਵਾਲੀ ਨਹਿਰ ਸੁੱਕ ਗਈ ਸੀਗੀ ਹਾਂਜੀ ਸਹੀ ਕਿਹਾ ਤੁਸੀਂ ਜੀ ਜੀ ਠੀਕ ਚੰਗਾ